ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਤੁਹਾਡੇ ਤੋਂ ਕੁੜਤੀ ਔਡਰ ਕੀਤੀ ਸੀਗੀ ਜਿਸਦੀ ਕਿ ਪੈਕਜਿੰਗ ਬਹੁਤ ਵਧੀਆ ਸੀਗੀ ਮੈਂ ਖੋਲਣ ਅਤੇ ਮੈਂ ਇਸਨੂੰ ਜਦੋਂ ਖੋਲਿਆ ਅਤੇ ਖੋਲ ਕੇ ਦੇਖਿਆ ਅਤੇ ਬਹੁਤ ਵਧੀਆ ਸੀਗੀ ਅਤੇ ਇਸ 'ਤੇ ਜੋ ਪ੍ਰਿੰਟ ਜੋ ਮੈਂ ਪ੍ਰਿੰਟ ਦੇਖਿਆ ਸੀਗਾ ਉਹ ਪ੍ਰਿੰਟ ਸੇਮ ਸੀਗਾ ਅਤੇ ਬਹੁਤ ਵਧੀਆ ਸੀਗਾ ਅਤੇ ਇਸਦਾ ਕਲਰ ਵੀ ਸੇਮ ਜੋ ਮੈਂ ਮੰਗਵਾਇਆ ਸੀਗਾ ਸੇਮ ਉਹੀ ਕਲਰ ਸੀਗਾ ਅਤੇ ਇਸਦਾ ਸਾਈਜ਼ ਵੀ ਮੇਰੇ ਮੇਰੇ ਲਈ ਫਿੱਟ ਸੀ ਅਤੇ ਮੇਰੇ ਫਿੱਟ ਆ ਗਿਆ ਇਸ ਦਾ ਕੱਪੜਾ ਵੀ ਬਹੁਤ ਵਧੀਆ ਸੀਗਾ ਅਤੇ ਜੋ ਇਸਦੀ ਸਟੀਚਿੰਗ ਕੀਤੀ ਹੋਈ ਸੀ ਉਹ ਵੀ ਬਹੁਤ ਵਧੀਆ ਕੀਤੀ ਹੋਈ ਸੀ ਅਤੇ ਇਹ ਮੈਨੂੰ ਮਾਰਕੀਟ ਨਾਲੋਂ ਔਨਲਾਈਨ ਔਡਰ ਕਰਨ 'ਤੇ ਬਹੁਤ ਸਸਤਾ ਪੈ ਗਿਆ ਇਹ ਮੇਰੇ ਮੇਰੇ ਘਰਦਿਆਂ ਨੇ ਮੇਰੀ ਭੈਣਾਂ ਨੇ ਅਤੇ ਮੇਰੀਆਂ ਦੋਸਤਾਂ ਨੇ ਸਭ ਨੇ ਪਸੰਦ ਕੀਤਾ ਅਤੇ ਉਹਨਾਂ ਨੇ ਵੀ ਮੈਨੂੰ ਪੁੱਛਿਆ ਕਿ ਕਿੱਥੋਂ ਔਡਰ ਕੀਤਾ ਅਤੇ ਉਹਨਾਂ ਨੇ ਮੈਨੂੰ ਪੁੱਛ ਕੇ ਔਡਰ ਔਨਲਾਈਨ ਔਡਰ ਕਰਿਆ ਅਤੇ ਉਹਨਾਂ ਨੇ ਵੀ ਦੇਖਿਆ ਕਿ ਜਦੋਂ ਉਹਦਾ ਔਨਲਾਈਨ ਔਡਰ ਕੀਤਾ ਹੋਇਆ ਸੀਗਾ ਜੋ ਮਿਂਸ ਉਹਨਾਂ ਦੀ ਕੁੜਤੀ ਆਈ ਅਤੇ ਸੇਮ ਕੁੜਤੀ ਓਦਾਂ ਦੀ ਸੀਗੀ ਕਲਰ ਵੀ ਸੇਮ ਸੀਗਾ ਅਤੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਮੈਨੂੰ ਉਹਨਾਂ ਦਾ ਕੁੜਤਾ ਵੀ ਬਹੁਤ ਜ਼ਿਆਦਾ ਵਧੀਆ ਲੱਗਿਆ ਇਸ ਕਰਕੇ ਅਸੀਂ ਅੱਗੇ ਤੋਂ ਤੁਹਾਡੇ ਤੋਂ ਹੀ ਔਡਰ ਔਡਰ ਕਰਦੇ ਰਹਾਂਗੇ ਧੰਨਵਾਦ